ਇਕ ਲੱਖ ਬਾਰ੍ਹਾਂ ਹਜ਼ਾਰ ਚਾਰ ਸੌ ਚੁਆਲ਼ੀ ਚਾਰ ਲੱਖ ਗਿਆਰ੍ਹਾਂ ਹਜ਼ਾਰ ਇੱਕ ਸੌ ਗਿਆਰ੍ਹਾਂ ਪੰਜ ਲੱਖ ਬਾਰ੍ਹਾਂ ਹਜ਼ਾਰ ਛੇ ਸੌ ਬਾਰ੍ਹਾਂ ਸੱਤ ਲੱਖ ਚੁਆਲ਼ੀ ਹਜ਼ਾਰ ਦੋ ਸੌ ਤੇਈ ਅੱਠ ਲੱਖ ਤੇਈ ਹਜ਼ਾਰ ਪੰਜ ਸੌ ਛੇ